ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂਬਰ ਜਿੰਨੇ ਮਰਜ਼ੀ ਤੁਸੀਂ ਹੋ ਆ ਜੋ ਰਿਹਾਇਸ਼ ਦਾ ਪ੍ਰਬੰਧ ਗੁਰੂ ਘਰ 'ਚ ਸਰਾਂਵਾਂ ਹੈਗੀਆਂ ਨੇ ਉੱਥੇ ਹੋ ਜਾਏਗਾ ਅਤੇ ਅੰਦਰ ਜਿਹੜੀ ਸੇਵਾ ਦੀ ਗੱਲ ਹੈ ਸੇਵਾ ਤੁਸੀਂ ਅੰਦਰ ਝਾੜੂ ਦੀ ਸੇਵਾ ਕਰ ਸਕਦੇ ਹੋ ਪਰਿਕਰਮਾ ਦੀ ਕਰ ਸਕਦੇ ਹੋ ਹੋਰ ਵੀ ਸੇਵਾ ਲੰਗਰ ਵਿੱਚ ਸੇਵਾ ਕਰ ਸਕਦੇ ਹੋ ਬਰਤਨਾਂ ਦੀ ਸਾਫ਼ ਕਰਨ ਦੀ ਲੰਗਰ ਵਰਤਾਉਣ ਦੀ ਪ੍ਰਸ਼ਾਦੇ ਪਕਾਉਣ ਦੀ ਅੰਦਰ ਜਲ ਦੀਆਂ ਛਬੀਲਾਂ ਹੈਗੀਆਂ ਨੇ ਉੱਥੇ ਸੇਵਾ ਕਰ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਸੇਵਾ ਤੁਸੀਂ ਕਰ ਸਕਦੇ ਹੋ ਜਿੰਨਾਂ ਚਿਰ ਮਰਜ਼ੀ ਕਰ ਸਕਦੇ ਹੋ ਕੋਈ ਉਹ 'ਚ ਪਾਬੰਦੀ ਨਹੀਂ ਜੀ ਠੀਕ ਹੈ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ